ਮੇਰਾ ਨਾਮ ਹਰਮਿੰਦਰ ਸਿੰਘ ਹੈ ਤੁਸੀਂ ਮੇਰੇ ਨਾਮ ਤੋਂ ਅੰਦਾਜਾ ਲਗਾ ਸਕਦੇ ਹੋ ਕਿ ਮੈਂ ਇੱਕ ਸਿੱਖ ਫੈਮਿਲੀ ਤੋਂ ਬਿਲੋਂਗ ਕਰਦਾ ਹਾਂ ਸਿੱਖ ਫੈਮਿਲੀ ਵਿੱਚ ਬੰਦਿਆਂ ਦੇ ਨਾਂ ਪਿੱਛੇ ਸਿੰਘ ਅਤੇ ਔਰਤਾਂ ਦੇ ਨਾਲ ਪਿੱਛੇ ਕੌਰ ਲਗਾਇਆ ਜਾਂਦਾ ਹੈ ਸਿੱਖ ਇਤਿਹਾਸ ਬਹੁਤ ਪੁਰਾਣਾ ਇਤਿਹਾਸ ਹੈ ਇਸ ਨੂੰ ਘਟਾਇਆ ਜਾਂ ਵ ਘਟਾਇਆ ਨਹੀਂ ਜਾ ਸਕਦਾ ਅਤੇ ਸਿੱਖ ਇਤਿਹਾਸ ਨੂੰ ਬਚਾਉਣ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ ਅਤੇ ਖਾਲਸੇ ਜਿਹਨਾਂ ਨੇ ਗਊ ਗਰੀਬ ਦੀ ਰੱਖਿਆ ਲਈ ਬਹੁਤ ਸਾਰੀਆਂ ਲੜਾਈਆਂ ਵੀ ਲੜੀਆਂ ਜਿਹਨਾਂ ਵਿੱਚ ਚਮਕੌਰ ਦੀ ਗ ਗੜੀ ਵਿੱਚ ਉਹਨਾਂ ਨੇ ਆਪਣੇ ਦੋ ਵੱਡੇ ਬੇਟਿਆਂ ਨੂੰ ਕੌਮ ਦੀ ਖਾਤਰ ਨਿਸ਼ਾਵਰ ਕਰ ਦਿੱਤਾ ਸੀ ਅਤੇ ਛੋਟੇ ਬੇਟਿਆਂ ਨੂੰ ਸਰਹੰਦ ਵਿਖੇ ਨੀਹਾਂ ਵਿੱਚ ਚਿਣਵਾ ਦਿੱਤਾ ਗਿਆ ਸੀ ਜਿਹਨਾਂ ਨੇ ਆਪਣੇ ਧਰਮ ਦੀ ਖਾਤਰ ਆਪਣਾ ਪੂਰਾ ਪਰਿਵਾਰ ਵ ਵਾਰ ਦਿੱਤਾ ਸੀ ਇਸ ਲਈ ਸਿੱਖ ਇਤਿਹਾਸ ਬਹੁਤ ਹੀ ਬੜਾ ਇਤਿਹਾਸ ਹੈ ਇਸ ਨੂੰ ਕੁਝ ਸਤਰਾਂ ਵਿੱਚ ਦੁਹਰਾਇਆ ਨਹੀਂ ਜਾ ਸਕਦਾ